ਗੁਲਾਬ ਜਾਮਣ ਰੱਸਗੁੱਲਾ ਮਿਲਕ ਕੇਕ ਮਲਾਈ ਬਰਫੀ ਪਿਸਤਾ ਬਰਫੀ ਬਦਾਮ ਬਰਫੀ ਕਾਜੂ ਬਰਫੀ ਡੋਡਾ ਬਰਫੀ ਸੋਨ ਪਾਪੜੀ ਪ ਪਟੀਸਾ ਸੇਵੀਆਂ ਦੀ ਖੀਰ ਚੌਲਾਂ ਦੀ ਖੀਰ ਬਰਸਨਵੀ ਮੋਮਸ ਦੀ ਖੀਰ ਫਿਰਨੀ ਗਜਰ ਦਾ ਹਲਵਾ ਮੂੰਗ ਦਲ ਦਾ ਹਲਵਾ ਅਲਸੀ ਦੀ ਪਿੰਨੀ ਗੁੜ ਦੀ ਪਿੰਨੀ ਬੇਸਣ ਦੀ ਪਿੰਨੀ ਮੱਖਣ ਦੀ ਮਿਸ਼ਰੀ

ਪਿੰਨੀਆਂ ਮਲਬੂਏ ਬਾਲੂ ਸ਼ਾਹੀ ਚੀਨੀ ਦਾ ਪੂੜਾ ਗੁੜ ਦਾ ਪੂੜਾ ਫੈਨੀਸ ਸੇਵੀਆਂ ਆਟੇ ਦਾ ਲਵਾ ਰਬੜੀ ਜਲੇਬੀ ਸੰਦੇਸ਼ ਸੰਦੇਸ਼ ਚਨਾ ਮੁਕਰੀ ਰਸ ਮਲਾਈ ਚਨਾ ਪੈਸਟਰੀ ਮਸਟਰੀ ਦੋਹੀ ਕਲਾਕੰਦ ਚਨਾ ਬਰਫੀ ਖਾਜਾ ਮਲਾਈ ਚਾਂਪ ਨਾਰੀਅਲ ਦੀ ਬਰਫੀ ਕਾਜੂ ਕਟਲੀ ਬਦਾਮ ਹਲਵਾ ਪਿਸਤਾ ਹਲਵਾ ਖਰੋੜ ਦੀ ਬਰਫੀ ਚੀਨੀ ਦਾ ਗੁਲਗੰਧ ਕਾਜੂ ਪਾਕ ਬਦਾਮ ਪਾਕ ਸੇਵੀਆਂ ਪਕੌਣ ਤਿਲ ਦੀ ਬਰਫੀ ਤਿਲ ਦੀ ਬਰਫੀ ਪੇਠਾ ਤਰਵਰਟ ਪੇਠਾ ਗੋਗਾ ਜੀ ਸੂਜੀ ਦੀ ਬਰਫੀ ਫਲੂ ਦੀ ਰਬੜੀ ਮੱਖਣ ਮਿਸ਼ਰੀ ਮਾ ਮੌਸਮੀ ਹਲਵਾ ਕਾਲਾ ਜਾਮੁਨ ਮਾਲਪੂਆ ਕੜਾਹ ਪ੍ਰਸ਼ਾਦ ਨਵਰਾਤਰੀ ਸੂਜੀ ਹਲਵਾ ਦਿਵਾਲੀ ਬਰਫੀ ਹੋਲੀ ਗੁਜੀਆ ਚੰਦੇਲ ਵਾਲਾ ਰੇਵੜੀ ਮਕਰ ਸ਼ੰਕਰਾਨਤੀ ਤਿਲ ਬਟਟੀ ਵਿਸਾਖੀ ਦੀ ਮਿਠਾਈ ਲੋੜੀ ਦੀ ਮਿਠਾਈ ਹਲਵਾ ਪੂਰੀ ਸ਼ਾ ਸ਼ਾਟ ਭਾਜਾ ਕੀ ਪੂਜਾ ਖੀਰ ਚਾਕਲੇਟ ਬਰਫੀ ਮਾਗੂ ਰਸਗੁੱਲਾ ਪੀਸਤਾ ਰਸ ਮਲਾਈ ਡਰਾਈ ਫਰੂਟ ਹਲਵਾ ਬਦਾਮ ਮਲਾਈ ਕਟਲੀ ਗੁੜ ਦੀ ਸੋਨ ਪਾਪੜੀ ਕੇਸਰ ਰਬੜੀ ਅੰਜੀਰ ਦੀ ਬਰਫੀ ਕੋਕੋਨਟ ਮਲਾਈ ਪੇਠਾ ਧੰਨਵਾਦ